ਜੇ ਪੰਜਾਬ ਸੱਭਿਆਚਾਰ ਮੈਂ ਭੰਗੜੇ ਦੀ ਗੱਲ ਕਰਾਂ ਤਾਂ ਇਹ ਇੱਕ ਫੋਕ ਡਾਂਸ ਹੈ ਅਤੇ ਇਸ ਦੀ ਜਿਹੜੀ ਮਹੱਤਤਾ ਉਹਦੇ ਵੱਲ ਗੱਲ ਕਰੀਏ ਤਾਂ ਇਹ ਪਹਿਲਾਂ ਭੰਗੜਾ ਜਿਹੜਾ ਵਿਆਹਾਂ ਦੇ ਵਿੱਚ ਜਾਂ ਮੇਲਿਆਂ ਦੇ ਵਿੱਚ ਹੁੰਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਭੰਗੜਾ ਸਕੂਲਾਂ 'ਚ ਕਾਲਜਾਂ 'ਚ ਯੂਨੀਵਰਸਿਟੀਆਂ ਵਿੱਚ ਆਪਣੀ ਇੱਕ ਅਹਿਮੀਅਤ ਰੱਖਦਾ ਹੈ ਇਹ ਮਰਦਾਂ ਵੱਲੋਂ ਬੜੇ ਹੀ ਜੋਰ ਦੇ ਨਾਲ ਬੜੇ ਹੀ ਢੰਗ ਦੇ ਨਾਲ ਜਿਹੜਾ ਭੰਗੜਾ ਉਹਨੂੰ ਕੀਤਾ ਜਾਂਦਾ ਹੈ